ਹਾਂਜੀ ਮੇਰਾ ਇੱਕ ਅਨੁਭਵ ਇਹ ਹੈ ਕਿ ਅਸੀਂ ਮੈਨੂੰ ਬਹੁਤ ਸ਼ੌਕ ਬਾਗਬਾਨੀ ਕਰਨ ਦਾ ਅਤੇ ਮੇਰੇ ਨਾਲ ਇੱਕ ਮੈਡਮ ਨੇ ਉਹਨਾਂ ਨੂੰ ਵੀ ਬਹੁਤ ਸ਼ੌਕ ਹੈ ਬਾਗਬਾਨੀ ਕਰਨ ਦਾ ਅਸੀਂ ਕੀ ਕਰਦੇ ਹੁੰਦੇ ਹਾਂ ਆਪਸ 'ਚ ਇੱਕ ਦੂਜੇ ਦੀ ਹੈਲਪ ਕਰਦੇ ਹੈਗੇ ਲਓ ਜੀ ਮੇਰੇ ਕੋਲ ਆਹ ਫਲਾਰ ਦਾ ਹੈਗਾ ਫੁੱਲਾਂ ਦਾ ਵੀ ਤੁਸੀਂ ਇਹ ਲਾ ਲਓ ਉਹ ਕਹਿਣਗੇ ਵੀ ਮੇਰੇ ਕੋਲ ਆਹ ਫੁੱਲਾਂ ਦਾ ਵੀ ਹੈਗਾ ਤੁਸੀਂ ਇਹ ਲਾ ਲਓ ਮੈਡਮ ਜਿਵੇਂ ਘਾਹ ਪਹਿਲਾ ਸਾਥੋਂ ਇੰਨਾ ਵਧੀਆ ਨਹੀਂ ਸੀ ਲੱਗਿਆ ਫਿਰ ਅਸੀਂ ਕਿਤੋਂ ਹੋਰ ਪ੍ਰੋਵਾਈਡ ਕਰਕੇ ਵਧੀਆ ਕਿਸਮ ਦਾ ਘਾਹ ਲਾਇਆ ਆਪਣੇ ਬਗੀਚੇ 'ਚ ਲੌਂਗ ਅਤੇ ਇਲਾਚੀ ਦਾ ਬੂਟਾ ਲਾਇਆ ਮੇਰੇ ਹਸਬੈਂਡ ਮੇਰੇ ਪਤੀ ਮੇਰੀ ਬਹੁਤ ਹੈਲਪ ਕਰਦੇ ਮੈਂ ਵੀ ਉਹਨਾਂ ਦੀ ਬਹੁਤ ਹੈਲਪ ਕਰਦੀ ਉਹਨਾਂ ਨੂੰ ਵੀ ਬਹੁਤ ਸ਼ੌਕ ਹੈ ਬਗੀਚਾ ਬਾਗਬਾਨੀ ਕਰਨ ਦਾ ਅਸੀਂ ਰਲ ਕੇ ਆਪਣਾ ਬਗੀਚਾ ਸਜਾਉਂਦੇ ਹਾਂ ਅਤੇ ਇੱਕ ਦੂਜੇ ਦਾ ਐਂ ਬਹੁਤ ਅਨੁਭਵ ਹੁੰਦਾ ਇਸ ਗੱਲ ਦਾ ਨਵੀਂ ਤੋਂ ਨਵੀਂ ਚੀਜ਼ ਸਿੱਖਦੇ ਹਾਂ ਤੁਸੀਂ ਇੱਕ ਪੌਦੇ ਕੋਲ ਖੜ੍ਹ ਕੇ ਉਹਨੂੰ ਡੇਲੀ ਪਾਣੀ ਦਿਓ ਉਹਦਾ ਧਿਆਨ ਰੱਖੋ ਉਹ ਪੌਦਾ ਛੇਤੀ ਗਰੋ ਕਰਦਾ ਛੇਤੀ ਵੱਧਦਾ ਅਤੇ ਇੱਕ ਤਾਂ ਤੁਸੀਂ ਇਕੱਲਾ ਪਾਣੀ ਪਾ ਕੇ ਛੱਡ ਦਿਆ ਕਰੋ ਤੁਸੀਂ ਮੈਂ ਇਹ ਚੀਜ਼ਾਂ ਪ੍ਰੈਕਟੀਕਲ ਕਰਕੇ ਦੇਖੀਆਂ ਨੇ ਉਹ ਨਾ ਇੰਨਾ ਵਧੀਆ ਵਧੇ ਫੁੱਲੇ ਅਤੇ ਨਾ ਹੀ ਉਹ ਇੰਨਾ ਅੱਛਾ ਗਰੋ ਕਰੇ ਇਸ ਕਰਕੇ ਪੌਦਿਆਂ 'ਚ ਵੀ ਜਾਨ ਹੁੰਦੀ ਹੈ ਵੀ ਇਸ ਫੀਲਿੰਗ ਸਮਝਦੇ ਆ ਮੈਨੂੰ ਬਹੁਤ ਅੱਛਾ ਅਨੁਭਵ ਹੋਇਆ ਆਪਣੇ ਬਗੀਚੇ ਦੀ ਹੈਲਪ ਆਪ ਵੀ ਕਰਕੇ ਅਤੇ ਦੂਜੇ ਦੀ ਵੀ ਹੈਲਪ ਕਰਕੇ